ਹੈਲੋ ਮੈਂ ਨੀਲਮ ਮੈਂ ਤੁਹਾਡੇ ਤੋਂ ਛੋਟੀ ਕੈਬ ਅਤੇ ਵੱਡੀ ਕੈਬ ਦੀਆਂ ਕੀਮਤਾਂ ਦੇ ਅੰਤਰ ਨੂੰ ਜਾਣਨਾ ਚਾਹੁੰਦੀ ਹਾਂ ਕਿਰਪਾ ਕਰਕੇ ਮੈਨੂੰ ਇੱਕ ਛੋਟੀ ਕੈਬ ਜੋ ਚਾਰ ਲੋਕਾਂ ਨੂੰ ਫਿੱਟ ਕਰਦੀ ਹੈ ਅਤੇ ਇੱਕ ਵੱਡੀ ਕੈਬ ਜੋ ਛੇ ਲੋਕਾਂ ਨੂੰ ਫਿੱਟ ਕਰਦੀ ਹੈ ਉਨ੍ਹਾਂ ਦੋਨਾਂ ਦੇ ਕਿਰਾਏ ਦਾ ਅੰਤਰ ਬਾਰੇ ਦੱਸਿਆ ਜਾਵੇ